ਸਾਡੇ ਆਸ ਪਾਸ ਬਹੁਤ ਭਜਨ ਮੰਡਲੀਆਂ ਹਨ ਸਾਡੀ ਖੁਦ ਦੀ ਇੱਕ ਭਜਨ ਮੰਡਲੀ ਹੈ ਜੋ ਮਤਲਬ ਅਸੀਂ ਕੀਰਤਨ ਵਗੈਰਾ ਕਰਦੇ ਹਾਂ ਜ਼ਿਆਦਾਤਰ ਔਰ ਉਹਦੇ ਵਿੱਚ ਅਸੀਂ ਢੋਲਕੀ ਛੈਣੇ ਚਿਮਟੇ ਔਰ ਕਾਫੀ ਚੀਜ਼ਾਂ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਪੀਕਰ ਵੀ ਹੈ ਸਾਡੇ ਪਾਸ ਜਿਹਦੇ ਨਾਲ ਅਸੀਂ ਗਾ ਭਜਨ ਗਾਉਂਦੇ ਹਾਂ ਔਰ ਢੋਲਕੀਆਂ ਵਜਾਉਂਦੇ ਹਾਂ ਔਰ ਸਾਰੀ ਲੇਡੀਜ਼ ਇਕੱਠੀਆਂ ਹੋ ਕੇ ਭਜਨ ਕਰਦੀਆਂ ਹਨ ਮੰਦਰ ਵਿੱਚ ਗੁਰਦੁਆਰੇ ਵਿੱਚ ਭਜਨ ਕੀਰਤਨ ਕਰਿਆ ਜਾਂਦਾ ਕਈ ਵਾਰ ਕਈਆਂ ਦੇ ਘਰਾਂ ਵਿੱਚ ਵੀ ਜਾ ਕੇ ਅਸੀਂ ਕੀਰਤਨ ਕਰਦੇ ਹਾਂ ਉਹ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛਾ ਟਾਈਮ ਪਾਸ ਵੀ ਹੁੰਦਾ ਇੱਕ ਤਰ੍ਹਾਂ ਦਾ ਭਜਨ ਕੀਰਤਨ ਕਰਨਾ ਔਰ ਮੰਡਲੀਆਂ ਜ਼ਿਆਦਾਤਰ ਲੇਡੀਜ਼ ਔਰ ਜੈਂਟਸ ਦੀਆਂ ਹੁੰਦੀਆਂ ਹਨ ਸਾਡੀ ਲੇਡੀਜ਼ ਦੀ ਆਪਣੀ ਇੱਕ ਮੰਡਲੀ ਹੈ ਜੋ ਬਹੁਤ ਅੱਛੀ ਤਰ੍ਹਾਂ ਭਜਨ ਕੀਰਤਨ ਕਰਦੇ ਹਨ ਔਰ ਸਾਡੇ ਕੋਲ ਸਾਰਾ ਸਮਾਨ ਹੈ ਜਿਸ ਤਰ੍ਹਾਂ ਢੋਲਕੀ ਛੈਣੇ ਚਿਮਟੇ ਔਰ ਸਪੀਕਰ ਸਭ ਕੁਛ ਦਰੀਆਂ ਵਗੈਰਾ ਅਸੀਂ ਖੁਦ ਆਪਣੀਆਂ ਬਣਾ ਰੱਖੀਆਂ ਤਾਂ ਅੱਛੀ ਮਤਲਬ ਇੱਕ ਭਜਨ ਮੰਡਲੀ ਜ਼ਰੂਰ ਹੋਣੀ ਚਾਹੀਦੀ ਹੈ ਹਰ ਪਿੰਡ ਵਿੱਚ ਜੋ ਮਤਲਬ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਦੱਸੇ